ਜ਼ਿਆਦਾਤਰ ਕੋਲਜ ਪਿੰਡਾਂ ਦੀ ਪਹੁੰਚ ਤੋਂ ਬਹੁਤ ਦੂਰ ਹਨ ਇਸ ਕਰਕੇ ਵਿਦਿਆਰਥੀਆਂ ਨੂੰ ਸਾਧਨ ਦੀ ਬਹੁਤ ਮੁਸ਼ਕਿਲ ਆਉਂਦੀ ਹੈ ਸਵੇਰੇ ਘਰੋਂ ਜਲਦੀ ਨਿਕਲਣਾ ਪੈਂਦਾ ਹੈ ਔਰ ਸ਼ਾਮ ਨੂੰ ਵੀ ਉਹਨਾਂ ਨੂੰ ਦੇਰੀ ਹੋ ਜਾਂਦੀ ਹੈ ਇਸ ਕਰਕੇ ਵਿਦਿਆਰਥੀ ਬਹੁਤ ਪਰੇਸ਼ਾਨ ਹੁੰਦੇ ਹਨ